ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਗਾਂਧੀ ਚੌਂਕ ਦੇ ਵਿੱਚ ਬਹੁਤ ਭੀੜ ਹੁੰਦੀ ਹੈ ਜੀ ਜੀ ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂ ਜਗ੍ਹਾ ਜਗ੍ਹਾ 'ਤੇ ਲੱਗੇ ਰਹਿੰਦੇ ਹਾਂਜੀ ਬਹੁਤ ਹੀ ਹੁੰਦੇ ਹੈ ਅਤੇ

ਹਾਂਜੀ ਬਹੁਤ ਹੁੰਦੀ ਹੈ ਜੀ ਜੀ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ